ਵਿਆਹ ਵਰਗੇ ਵੱਡੇ ਸਮਾਰੋਹ ਦੌਰਾਨ ਵੱਡੀ ਮਾਤਰਾ ਵਿੱਚ ਅਸੀਂ ਕਈ ਵੱਡੇ ਟੈਂਕਰ ਅਤੇ ਛੱਤ 'ਤੇ ਰੱਖੀਆਂ ਹੋਈਆਂ ਜਿਹੜੀਆਂ ਟੈਂਕੀਆਂ ਦਾ ਇਸਤੇਮਾਲ ਹੁੰਦਾ ਹੈ ਉਹਨਾਂ ਨੂੰ ਬਾਜ਼ਾਰ ਵਿੱਚੋਂ ਆਰ ਓ ਵਾਲੇ ਫਿਲਟਰ ਤੋਂ ਭਰਵਾ ਕੇ ਲੈ ਕੇ ਆਉਂਦੇ ਹੈ ਵੈਸੇ ਤਾਂ ਅੱਜ ਕੱਲ੍ਹ ਸ਼ਹਿਰਾਂ ਦੇ ਵਿੱਚ ਵਾਟਰ ਬਾਕਸ ਤੋਂ ਪਾਣੀ ਦੀ ਸਪਲਾਈ ਹਰ ਥਾਂ ਕੀਤੀ ਜਾਂਦੀ ਹੈ ਪਰ ਕਈ ਥਾਵਾਂ 'ਤੇ ਵਾਟਰ ਬਾਕਸ ਦੀ ਸਪਲਾਈ ਨਾ ਹੋਣ ਕਰਕੇ ਅਸੀਂ ਬਾਜ਼ਾਰ ਵਿੱਚ ਆਰ ਓ ਫਿਲਟਰ ਬਣੇ ਹੋਏ ਹੈ ਉੱਥੋਂ ਅਸੀਂ ਵੱਡੇ ਟੈਂਕਰ ਅਤੇ ਟੈਂਕੀਆਂ ਨੂੰ ਭਰਵਾ ਕੇ ਅਸੀਂ ਜਿਸ ਜਗ੍ਹਾ 'ਤੇ ਵੱਡੇ ਪੱਧਰ 'ਤੇ ਜਾਂ ਵੱਡੇ ਸਮਾਰੋਹ ਵਿੱਚ ਵਿਆਹ ਦੇ ਸਮਾਰੋਹ ਵਿੱਚ ਅਸੀਂ ਉਸ ਪਾਣੀ ਨੂੰ ਲਿਜਾ ਕੇ ਅਸੀਂ ਪਾਣੀ ਦੀ ਵਰਤੋਂ ਕਰਦੇ ਹਾਂ ਪਰ ਵਿਆਹ ਦੇ ਵਿੱਚ ਅਸੀਂ ਪੀਣ ਵਾਲੇ ਪਾਣੀ ਨੂੰ ਅੱਜ ਕੱਲ੍ਹ ਬਾਜ਼ਾਰ ਵਿੱਚੋਂ ਮਿਲ ਰਹੀਆਂ ਰੇਡੀਮੇਟ ਬੋਤਲਾਂ ਅਤੇ ਡਿਸਪੋਜਲ ਗਿਲਾਸ ਪਾਣੀ ਵਾਲੇ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਕਈ ਥਾਵਾਂ 'ਤੇ ਅਸੀਂ ਆਰ ਓ ਤੋਂ ਲਿਆ ਕੇ ਕੈਂਪਰ ਦਾ ਇਸਤੇਮਾਲ ਕਰਦੇ ਹੈ ਜਿਸ ਤਰ੍ਹਾਂ ਅਸੀਂ ਵਿਆਹ ਦੇ ਵਿੱਚ ਬੁਲਾਇਆ ਗਿਆ ਹੈ ਮੈਂਬਰਾਂ ਨੂੰ ਅਸੀਂ ਉਸ ਤੋਂ ਉਸ ਦੇ ਅਕੋਰਡਿੰਗ ਅਸੀਂ ਪਾਣੀ ਦੀ ਵਰਤੋਂ ਦਾ ਇਸਤੇਮਾਲ ਕਰਦੇ ਹਾਂ